ਹਾਂਜੀ ਮੈਂ ਅਮਿਤਾ ਬੋਲ ਰਹੀ ਹਾਂ ਇੱਥੋਂ ਦੋ ਕਿਲੋਮੀਟਰ ਦੀ ਦੂਰੀ 'ਤੇ ਇੱਕ ਰੈਸਟੋਰੈਂਟ ਖੁੱਲ੍ਹਿਆ ਹੈ ਜਿਸ ਦਾ ਨਾਂ ਆਪਣੀ ਰਸੋਈ ਹੈ ਨਾਮ ਤੋਂ ਤਾਂ ਇੰਝ ਲੱਗਦਾ ਹੈ ਜਿਵੇਂ ਕਿ ਇਹ ਇਸ ਦਾ ਰੋਟੀ ਦਾ ਸਵਾਦ ਘਰ ਦੀ ਰੋਟੀ ਵਰਗਾ ਹੀ ਹੋਵੇਗਾ ਮੇਰੇ ਰਿਸ਼ਤੇਦਾਰਾਂ ਨੇ ਘਰ ਆਉਣਾ ਹੈ ਅਤੇ ਮੈਂ ਸੋਚਦੀ ਹਾਂ ਕਿ ਇੱਥੋਂ ਖਾਣਾ ਮੰਗਵਾ ਲਿਆ ਜਾਵੇ ਮੈਂ ਇੱਥੋਂ ਸ਼ਾਹੀ ਪਨੀਰ ਦੀ ਸਬਜ਼ੀ ਅਤੇ ਬਟਰ ਨਾਨ ਮੰਗਵਾਉਣੇ ਹਨ ਤੁਸੀਂ ਮੈਨੂੰ ਦੱਸੋਗੇ ਕਿ ਇਹ ਰੈਸਟੋਰੈਟ ਵਾਲੇ ਖਾਣਾ ਕਿਵੇਂ ਬਣਾਉਂਦੇ ਹਨ ਅਤੇ ਕਿੰਨਾ ਕੁ ਖ਼ਰਚਾ ਆਉਂਦਾ ਹੈ ਕੀ ਇਹ ਹੋਮ ਡਿਲੀਵਰੀ ਵੀ ਕਰਦੇ ਨੇ ਅਤੇ ਕਿੰਨੇ ਮਿੰਟ ਵਿੱਚ ਇਹ ਘਰ ਖਾਣਾ ਪਹੁੰਚਦਾ ਕਰਦੇ ਹਨ ਅਤੇ ਇਹ ਰੈਸਟੋਰੈਂਟ ਵਾਲੇ ਕਿੰਨਾ ਕੁ ਡਿਸਕਾਊਂਟ ਦਿੰਦੇ ਹਨ ਮੈਂ ਇੱਕ ਚੀਜ਼ ਬਹੁਤ ਜ਼ਰੂਰੀ ਪਤਾ ਕਰਨਾ ਚਾਹੁੰਦੀ ਹਾਂ ਕਿ ਇੱਥੇ ਖਾਣਾ ਸ਼ੁੱਧ ਸ਼ਾਕਾਹਾਰੀ ਹੀ ਬਣਦਾ ਹੈ ਜਾਂ ਇਸ ਇੱਥੇ ਮਾਸ ਮੱਛੀ ਵੀ ਮਿਲਦੀ ਹੈ ਅਗਰ ਇੱਥੇ ਸ਼ੁੱਧ ਸ਼ਾਕਾਹਾਰੀ ਭੋਜਨ ਬਣਦਾ ਹੈ ਤਾਂ ਬਿਹਤਰ ਅਗਰ ਇੱਥੇ ਮਾਸ ਮੱਛੀ ਵਾਲਾ ਭੋਜਨ ਬਣਦਾ ਹੈ ਤਾਂ ਅਸੀਂ ਇੱਥੋਂ ਭੋਜਨ ਨਹੀਂ ਮੰਗਵਾਵਾਂਗੇ ਕਿਉਂਕਿ ਸਾਡੇ ਮਾਤਾ ਜੀ ਸ਼ੁੱਧ ਸ਼ਾਕਾਹਾਰੀ ਹਨ ਸ਼ੁੱਧ ਵੈਸ਼ਨੂੰ ਹਨ